ਅੱਜ ਕੱਲ੍ਹ ਸਾਇੰਸ ਅਤੇ ਟੈਕਨੋਲਜੀ ਦਾ ਯੁੱਗ ਹੈ ਟੈਕਨੋਲਜੀ ਨੇ ਤਾਂ ਸਾਡੀ ਪੂਰੀ ਜ਼ਿੰਦਗੀ ਨੂੰ ਹੀ ਬਦਲ ਦਿੱਤਾ ਹੈ ਟੈਕਨੋਲਜੀ ਵਿੱਚ ਤਾਂ ਅ ਇਤਨੀ ਤਰੱਕੀ ਹੋ ਗਈ ਹੈ ਕਿ ਅੱਜ ਕੱਲ੍ਹ ਕਿ ਬਹੁਤ ਸਾਰੇ ਪੁਰਾਣੇ ਲੋਕ ਤਾਂ ਉਸ ਨੂੰ ਕਦੀ ਸੋਚ ਵੀ ਨਹੀਂ ਸਕਦੇ ਸਨ ਮੋਬਾਇਲ ਦੇ ਆਉਣ ਨਾਲ ਅਸੀਂ ਘਰ ਬੈਠੇ ਹੀ ਦੇਸ਼ ਵਿਦੇਸ਼ ਵਿੱਚ ਜਿਸ ਨਾਲ ਮਰਜ਼ੀ ਗੱਲ ਕਰ ਸਕਦੇ ਹਾਂ ਅਸੀਂ ਮੋਬਾਇਲ ਦੇ ਉੱਤੇ ਇੰਟਰਨੈੱਟ ਬੈਂਕਿੰਗ ਰਾਹੀਂ ਅਸੀਂ ਪੈਸੇ ਦਾ ਟਰਾਂਜੈਕਸ਼ਨ ਲੈਣ ਦੇਣ ਕਰ ਸਕਦੇ ਹਾਂ ਯੂ ਪੀ ਆਈ ਦੇ ਨਾਲ ਇਹ ਤਾਂ ਹੋਰ ਵੀ ਸੌਖਾ ਹੋ ਗਿਆ ਹੈ ਮੋਬਾਇਲ ਦੇ ਉੱਤੇ ਹੀ ਅਸੀਂ ਅੱਜ ਕੱਲ੍ਹ ਰੇਲਵੇ ਜਾਂ ਏਅਰ ਦੀ ਟਿਕਟ ਬੁੱਕਿੰਗ ਵੀ ਵੀ ਕਰ ਸਕਦੇ ਹਾਂ ਸਾਰੀ ਖ਼ਬਰਾਂ ਵੀ ਪੜ੍ਹ ਲੈਂਦੇ ਹਾਂ ਬਹੁਤ ਕੁਛ ਕਰ ਸਕਦੇ ਹਾਂ ਟੈਕਨੋਲਜੀ ਦੇ ਨਾਲ ਬਹੁਤ ਸਾਰੇ ਨਵੇਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਜਿਵੇਂ ਕਿ ਗੱਡੀਆਂ ਦੇ ਬਹੁਤ ਸਾਰੀ ਨਵੀਂ ਟੈਕਨੋਲਜੀ ਦੀ ਵਰਤੋਂ ਹੁੰਦੀ ਹੈ ਬਹੁਤ ਸਾਰੇ ਸੈਂਸਰ ਲੱਗੇ ਹੁੰਦੇ ਹਨ ਜਿਵੇਂ ਕਿ ਪਾਰਕਿੰਗ ਸੈਂਸਰ ਟੈਂਪਰੇਚਰ ਸੈਂਸਰ ਕੰਟਰੋਲ ਸੈਂਸਰ ਇਹ ਸਾਰਾ ਟੈਕਨੋਲਜੀ ਦਾ ਹੀ ਕਮਾਲ ਹੈ ਪਹਿਲਾਂ ਟੀ ਵੀ 'ਤੇ ਦੂਰਦਰਸ਼ਨ ਦਾ ਇੱਕੋ ਹੀ ਚੈਨਲ ਆਉਂਦਾ ਸੀ ਹੁਣ ਨਾ ਇੰਨੇ ਚੈਨਲ ਆ ਗਏ ਹਨ ਕਿ ਬਹੁਤ ਸਾਰੇ ਹਰੇਕ ਬੰਦਾ ਆਪਣੀ ਮਰਜੀ ਨਾਲ ਚੈਨਲ ਦੇਖ ਸਕਦਾ ਹੈ ਔ ਟੀ ਟੀ ਪਲੇਟਫਾਰਮ ਦੇ ਨਾਲ ਬੰਦਾ ਬਹੁਤ ਸੌਖੇ ਤਰੀਕੇ ਨਾਲ ਆਪਣੀ ਮਰਜੀ ਦੀ ਫਿਲਮ ਲੱਭ ਕੇ ਦੇਖ ਸਕਦਾ ਹੈ ਉਹ ਕਦੋਂ ਵੀ ਆਪਣਾ ਪੁਰਾਣਾ ਚ ਕੋਈ ਵੀ ਸੀਰੀਅਲ ਕਦੋਂ ਵੀ ਦੇਖ ਸਕਦਾ ਹੈ ਟੈਕਨੋਲਜੀ ਨਾਲ ਅਸੀਂ ਔਨਲਾਈਨ ਰਾਹੀਂ ਜਦੋਂ ਵੀ ਸਮਾਨ ਮੰਗਵਾਉਂਦੇ ਹਾਂ ਤਾਂ ਉਸ ਨੂੰ ਪਸੰਦ ਨਾ ਆਏ ਤਾਂ ਅਸੀਂ ਅਸਾਨੀ ਨਾਲ ਵਾਪਿਸ ਵੀ ਕਰ ਸਕਦੇ ਹਾਂ ਪਰ ਜਦੋਂ ਅਸੀਂ ਬਜ਼ਾਰ ਵਿੱਚ ਜਾ ਕੇ ਸਮਾਨ ਕਈ ਵਾਰ ਵਾਪਿਸ ਕਰਦੇ ਹਾਂ ਅਤੇ ਦੁਕਾਨਦਾਰ ਬੜ੍ਹੀ ਬੜੀ ਮੁਸ਼ਕਿਲ ਨਾਲ ਸਾਨੂੰ ਸਮਾਨ ਵਾਪਿਸ ਕਰਦਾ ਹੈ ਅਤੇ ਇਸ ਤਰ੍ਹਾਂ ਟੈਕਨੋਲਜੀ ਨਾਲ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਬਦਲਾਅ ਆ ਗਿਆ ਹੈ ਸਾਡੀ ਜ਼ਿੰਦਗੀ ਬਹੁਤ ਹੀ ਅਸਾਨ ਬਣ ਗਈ ਹੈ